ਮੇਰੇ ਅਧਿਆਤਮਿਕ ਅਧਿਆਪਕ ਹਨ ਗਿਆਨੀ ਸੰਤ ਸਿੰਘ ਜੀ ਮਸਕੀਨ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਡਾਕਟਰ ਸਰਬਜੀਤ ਸਿੰਘ ਜੀ ਰੇਨੂਕਾ ਵੈਸੇ ਤਾਂ ਸਿੱਖ ਹੋਣ ਦੇ ਨਾਤੇ ਸਾਡੇ ਸਾਰਿਆਂ ਦੇ ਅਧਿਆਤਮਿਕ ਗੁਰੂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਕਈ ਰੋਜ਼ਾਨਾ ਜੀਵਨ ਜਾਂਚ ਦੀਆਂ ਗੱਲਾਂ ਸੀਨਾ ਬਸੀਨਾ ਵੀ ਚਲਦੀਆਂ ਆ ਰਹੀਆਂ ਹਨ ਮੈਂ ਸਮਝਦਾ ਹਾਂ ਕਿ ਸਾਰਿਆਂ ਦਾ ਹੀ ਕੋਈ ਨਾ ਕੋਈ ਅਧਿਆਤਮਿਕ ਅਧਿਆਪਕ ਤਾਂ ਹੋਣਾ ਹੀ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਪਦਾਰਥਵਾਦੀ ਦੁਨੀਆ ਵਿੱਚ ਖਚਤ ਹੁੰਦੇ ਹਾਂ ਤਾਂ ਅਸੀਂ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਜਿਨ ਦਿੰਦੇ ਹਾਂ ਪਰ ਮਨੁੱਖ ਇੱਕ ਪਦਾਰਥ ਨਹੀਂ ਹੈ ਮਨੁੱਖਾਂ ਵਿੱਚ ਭਾਵਨਾਤਮਕ ਅਤੇ ਮਾਨਸਿਕ ਗੱਲਾਂ ਵੀ ਹੁੰਦੀਆਂ ਹਨ ਮਨੁੱਖ ਭਾਵਨਾਤਮਕ ਅਤੇ ਮਾਨਸਿਕ ਤਲ 'ਤੇ ਵੀ ਜਿਉਂਦਾ ਹੈ ਭਾਵਨਾਤਮਕ ਅਤੇ ਮਾਨਸਿਕ ਰੋਗ ਅੱਜਕੱਲ ਬਹੁਤ ਜਿਆਦਾ ਵਧ ਚੁੱਕੇ ਹਨ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਵਿੱਚ ਇਮੋਸ਼ਨਲ ਅਤੇ ਮੈਂਟਲ ਇਮਬੈਲੈਂਸ ਵੀ ਕਹਿੰਦੇ ਹਾਂ ਕਿਉਂਕਿ ਹਰੇਕ ਬੰਦੇ ਦੀਆਂ ਪਦਾਰਥੀ ਲੋੜਾਂ ਦੇ ਨਾਲ ਨਾਲ ਭਾਵਨਾਤਮਕ ਅਤੇ ਮਾਨਸਿਕ ਲੋੜਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਇਹ ਆਤਮਿਕ ਅਧਿਆਪਕ ਜਿਨ੍ਹਾਂ ਦੇ ਮੈਂ ਨਾਮ ਲਏ ਹਨ ਇੱਕ ਦੋ ਤਾਂ ਮੈਨੂੰ ਮੇਰੇ ਮਾਤਾ ਜੀ ਤੋਂ ਪਤਾ ਲੱਗੇ ਸਨ ਅਤੇ ਮੈਂ ਛੋਟੇ ਹੁੰਦਿਆਂ ਤੋਂ ਹੀ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਸੁਣਦਾ ਆ ਰਿਹਾ ਹਾਂ ਅਤੇ ਡਾਕਟਰ ਸਰਬਜੀਤ ਸਿੰਘ ਰੇਨੂਕਾ ਬਾਰੇ ਮੈਨੂੰ ਆਪਣੇ ਇੱਕ ਦੋਸਤ ਕੋਲੋਂ ਪਤਾ ਲੱਗਾ ਸੀ